ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ

ਹਾਂਜੀ ਇਹ ਇਹ ਸਰ ਜਿਵੇਂ ਹੁਣ ਸਾਡਾ ਏਰੀਆ ਹੋ ਗਿਆ ਇਹਦੇ ਵਿੱਚ ਨਾ ਵਹਿਮ ਭਰਮ ਬਹੁਤ ਫੈਲੇ ਹੋਏ ਲੋਕ ਨਾ ਖੰਡਾ ਦੇ ਪਿੱਛੇ ਜ਼ਿਆਦਾ ਲੱਗਦੇ ਪਏ ਨੇ ਜਿਵੇਂ ਕਹਿੰਦੇ ਬਿੱਲੀ ਜਿਹੜਾ ਰਸਤਾ ਕੱਟ ਜੇ ਤਾਂ ਜਾਣਾ ਨਹੀਂ ਚਾਹੀਦਾ ਬਿੱਲੀ ਦਾ ਵਹਿਮਾ ਭਰਮਾ ਨਾ ਕੀ ਦੱਸੋ ਹੁਣ ਬਿੱਲੀ ਨੇ ਤਾਂ ਲੰਘਣਾ ਉਹਨੇ ਤਾਂ ਆਪਦਾ ਰਸਤਾ ਲੰਘਣਾ ਵਾ ਜਿੱਧਰ ਦੀ ਮਰਜ਼ੀ ਜਾ ਸਕਦੀ ਹੈ ਅਤੇ ਹੁਣ ਬਿੱਲੀ ਜੇ ਆਪਣੇ ਅੱਗੋਂ ਦੀ ਲੰਘ ਜਾਊਗੀ ਤਾਂ ਇਹਦਾ ਮਤਲਬ ਇਹ ਥੋੜ੍ਹੀ ਬਈ ਉਹ ਆਪਣਾ ਰਸਤਾ ਕੱਟ ਗਈ ਅਤੇ ਹੁਣ ਜਿਹੜੇ ਮਤਲਬ ਲੋਕ ਕਹਿੰਦੇ ਆ ਬਈ ਰਾਤ ਨੂੰ ਮਾਮਾ ਭਾਂਣਜਾ ਮੀਂਹ 'ਚ ਬਾਹਰ ਨਹੀਂ ਜਾ ਸਕਦੇ ਮਾਮਾ ਭਾਂਣਜਾ ਵੀ ਜਦੋਂ ਮਰਜ਼ੀ ਇਹ ਵੀਰ ਜਿਵੇਂ ਹੁਣ ਉਨ ਉਹ ਕਹਿੰਦੇ ਆ ਬਈ ਲੋਕਾਂ ਦੇ ਇਹ ਸੋਚਣਾ ਜੇ ਮਾਮਾ ਭਾਣਜਾ ਮੀਂਹ 'ਚ ਬਾਹਰ ਜਾਣਗੇ ਉਹਨਾਂ ਉੱਪਰ ਬਿਜਲੀ ਡਿੱਗ ਪਊਗੀ ਇਹ ਸਾਰੇ ਨਾ ਆਪਣੇ ਲੋਕਾਂ ਨੇ ਭਰਮ ਬਣਾਏ ਹੋਏ ਆ ਇਹਦਾ ਕੋਈ ਮਤਲਬ ਨਹੀਂ ਨਿਕਲਦਾ ਕੋਈ ਅਰਥ ਨਹੀਂ ਹੈਗਾ ਜੀ ਇਹਦਾ ਹਾਂਜੀ ਸਰ ਮੈਂ ਦੋ ਤਿੰਨ ਦਿਨ ਹੁਣ ਬਾਹਰ ਸਰਚ ਹੀ ਕਰਦਾ ਪਿਆ ਹਾਂ ਇਸੇ ਟੋਪਿਕਾਂ 'ਤੇ ਹੀ ਅਤੇ ਮੈਂ ਵੀ ਲੋਕਾਂ ਤੋਂ ਜਾਣਕਾਰੀ ਇਕੱਠੀ ਕਰਦਾ ਪਿਆ ਹਾਂ ਅਤੇ ਕੋਈ ਨਹੀਂ ਦੋ ਤਿੰਨ ਦਿਨ ਬਾਅਦ ਆਪਾਂ ਜਦੋਂ ਵੀ ਟਾਈਮ ਲੱਗਾ ਮੈਂ ਤੁਹਾਨੂੰ ਦੱਸ ਦੂੰਗਾ ਆਪਾਂ ਜ਼ਰੂਰ ਮਿਲਾਂਗੇ ਜੀ ਠੀਕ ਹੈ ਵੀਰ ਜੀ ਓਕੇ ਜੀ ਓਕੇ ਸਰ